ਹੈਲੋ ਸਰ ਮੈਂ ਅਤੁਲ ਬੋਲ ਰਿਹਾ ਗੁਰਦਾਸਪੁਰ ਤੋਂ ਮੈਂ ਇੱਕ ਹਫ਼ਤੇ ਪਹਿਲਾਂ ਤੁਹਾਡੇ ਤੋਂ ਇੱਕ ਫੋਨ ਮੰਗਵਾਇਆ ਸੀ ਰੀਅਲਮੀ ਏਟ ਕਰਕੇ ਮੈਂ ਉਹਦਾ ਰਿਵਿਊ ਦੇਣਾ ਭੁੱਲ ਗਿਆ ਸੀ ਇਸ ਕਰਕੇ ਮੈਂ ਹੁਣ ਫੋਨ ਕਰ ਰਿਹਾ ਤੁਹਾਨੂੰ ਇਹਦੇ ਬਾਰੇ ਦੱਸਣ ਲਈ ਮੈਂ ਸਰ ਕਹਿਣਾ ਚਾਹੁੰਦਾ ਕਿ ਥੈਂਕ ਯੂ ਬਹੁਤ ਵਧੀਆ ਫੋਨ ਸੀ ਬਹੁਤ ਵਧੀਆ ਡਿਲੀਵਰੀ ਸੀ ਇੱਕ ਵਾਰ ਵੀ ਮੈਨੂੰ ਕੁਛ ਆਉਂਦਾ ਦਿੱਕਤ ਨਹੀਂ ਹੋਈ ਇੱਕ ਵਾਰ ਉਹਦਾ ਸਿਰਫ਼ ਆਇਆ ਡਿਲੀਵਰੀ ਵਾਲੇ ਦਾ ਫੋਨ ਉਸ ਟਾਈਮ ਸਾਨੂੰ ਫੋਨ ਰਿਸੀਵ ਹੋ ਗਿਆ ਓਪਨ ਬੋਕਸ ਡਿਲੀਵਰੀ ਸੀ ਜਿਹਦੀ ਬਾਇਆ ਕਿ ਉਹਨੇ ਕਿਹਾ ਉੱਥੇ ਹੀ ਫੋਨ ਖੋਲ੍ਹ ਕੇ ਦਿਖਾ ਤਾ ਕਿ ਕੋਈ ਦਿੱਕਤ ਹੋਰ ਵੀ ਨਹੀਂ ਆਈ ਉਸ ਤੋਂ ਇਲਾਵਾ ਫੋਨ ਮੈਂ ਹੁਣ ਚਲਾ ਰਿਹਾ ਜੋ ਕਿ ਨਾ ਹੈਂਗ ਹੁੰਦਾ ਹੈ ਨਾ ਉਹਦੇ ਵਿੱਚ ਕੋਈ ਹੋਰ ਦਿੱਕਤ ਹੈ ਉਸ ਤੋਂ ਇਲਾਵਾ ਫੋਨ ਦੇ ਵਿੱਚ ਨਾਲ ਬੋਕਸ ਦੇ ਚਾਰਜਰ ਹੋਰ ਉਹਦੇ ਹੈਡ ਫੋਨ ਜਿਹੜਾ ਹੁੰਦਾ ਵਾ ਕੇਸ ਉਹ ਸਭ ਕੁਝ ਆਇਆ ਸੀ ਸਰ ਜੋ ਕਿ ਬਹੁਤ ਵਧੀਆ ਗੱਲ ਆ ਹਾਲਾਂਕਿ ਕਈ ਫੋਨਾਂ ਵਿੱਚ ਅੱਜ ਕੱਲ੍ਹ ਨਹੀਂ ਆ ਰਿਹਾ ਮੈਂ ਇਹਦੇ ਲਈ ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ ਹਾਂ ਹਾਲਾਂਕਿ ਉਸ ਤੋਂ ਇਲਾਵਾ ਫਲਿਪਕਾਰਟ 'ਤੇ ਡਿਸਕਾਊਂਟ ਵੀ ਬਹੁਤ ਜ਼ਿਆਦਾ ਮਿਲ ਗਿਆ ਸੀ ਮੈਨੂੰ ਜੋ ਕਿ ਮੇਰੇ ਘਰ ਦੇ ਵੀ ਬਹੁਤ ਖੁਸ਼ ਹੋ ਗਏ ਸੀ ਕਿ ਕਾਫ਼ੀ ਸਸਤੇ ਵਿੱਚ ਕਾਫ਼ੀ ਵਧੀਆ ਫੋਨ ਮਿਲ ਗਿਆ ਇਸ ਕਰਕੇ ਸਰ ਮੈਂ ਕਹਿਣਾ ਚਾਹੁੰਦਾ ਹਾਂ ਥੈਂਕ ਯੂ ਅਤੇ ਫੋਨ ਦਾ ਬਹੁਤ ਵਧੀਆ ਇਹਦੇ ਲਈ ਮੇਰਾ ਫਾਈਵ ਸਟਾਰ ਰਿਵਿਊ ਮੈਂ ਦੇਣਾ ਚਾਹੁੰਦਾ ਹਾਂ ਥੈਂਕ ਯੂ ਫਲਿਪਕਾਰਟ ਨੂੰ ਵੀ ਅਤੇ ਰੀਅਲਮੀ ਕੰਪਨੀ ਨੂੰ ਵੀ